ਹੈਲੋ ਨਮਸਕਾਰ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਮੇਰੇ ਗੈਸ ਏਜੰਸੀ ਦੇ ਵਿੱਚ ਮੈਂ ਜਦੋਂ ਸਿਲੰਡਰ ਬੁੱਕ ਕੀਤਾ ਸੀ ਤਾਂ ਮੇਰੇ ਗੈਸ ਸਿਲੰਡਰ ਦੀ ਸਪੁਰਦਗੀ ਸਪੁਰਦਗੀ ਵਿੱਚ ਦੇਰੀ ਹੋ ਗਈ ਸੀ ਬਟ ਪਰ ਪਰ ਜੋ ਕਿ ਗਾਹਕ ਸਹਾਇਤਾ ਟੀਮ ਨੇ ਇਸ ਮੁੱਦੇ ਨੂੰ ਸੰਭਾਲਿਆ ਅਤੇ ਮੇਰਾ ਪੂਰੇ ਟਾਈਮ 'ਤੇ ਮੇਰੇ ਘਰ ਮੇਰੇ ਗੈਸ ਸਿਲੰਡਰ ਪਹੁੰਚਾਇਆ ਸੋ ਇਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ